ਸਤਿ ਸ਼੍ਰੀ ਅਕਾਲ ਜੀ ਜਿਹੜੇ ਪੇੜ ਪੌਦੇ ਨੇ ਜੀ ਉਹ ਭਾਵੇਂ ਸਰਦੀ ਹੋਵੇ ਗਰਮੀ ਹੋਵੇ ਜਾਂ ਭਾਵੇਂ ਬਰਸਾਤ ਦਾ ਮੌਸਮ ਹੋਵੇ ਇਹ ਤਾਂ ਆਪਣਾ ਪ੍ਰਭਾਵ ਛੱਡਦੇ ਹੀ ਛੱਡਦੇ ਆ ਮੌਸਮ ਪੌਦਿਆਂ ਦੇ ਉੱਤੇ ਪੇੜ ਪੌਦਿਆਂ ਦੇ ਉੱਤੇ ਜਿਵੇਂ ਜੀ ਗਰਮੀਆਂ ਦੇ ਵਿੱਚ ਪੇੜ ਪੌਦੇ ਨੂੰ ਹਰ ਇੱਕ ਪੌਦੇ ਨੂੰ ਪਾਣੀ ਦੀ ਵੱਧ ਤੋਂ ਵੱਧ ਲੋੜ ਹੁੰਦੀ ਹੈ ਜਿੰਨੀ ਜ਼ਿਆਦਾ ਗਰਮੀ ਓਨਾ ਹੀ ਪੌਦਾ ਛੇਤੀ ਮੁਰਝਾ ਜਾਂਦਾ ਹੈ ਅਤੇ ਉਹਨੂੰ ਪਾਣੀ ਜ਼ਿਆਦਾ ਆਪਾਂ ਦੇਣਾ ਪੈਂਦਾ ਉਹਦੀ ਇੰਨੀ ਧਿਆਨ ਉਹਦਾ ਇੰਨੀ ਰਖਵਾਲੀ ਰਾਖੀ ਕਰਨੀ ਪੈਂਦੀ ਆਪਾਂ ਨੂੰ ਅਤੇ ਦੂਜੀ ਗੱਲ ਜੀ ਉਹਨਾਂ 'ਤੇ ਜਿਹੜੇ ਜਿਵੇਂ ਸਬਜ਼ੀਆਂ ਹੋ ਗਈ ਜਾਂ ਫਰੂਟ ਹੋ ਗਏ ਉਹ ਜਿਹੜੇ ਲੱਗਦੇ ਆ ਉਹਨਾਂ ਨੂੰ ਆਪਾਂ ਛੇਤੀ ਤੋਂ ਛੇਤੀ ਲੱਗਣ ਤੋਂ ਬਾਅਦ ਤੋੜਨਾ ਹੁੰਦਾ ਗਰਮੀਆਂ ਦੇ ਵਿੱਚ ਨਹੀਂ ਤਾਂ ਉਹ ਇੱਕ ਦੋ ਦਿਨ ਜੇ ਆਪਾਂ ਨਹੀਂ ਤੋੜੇ ਨਹੀਂ ਉਹਨਾਂ ਨੂੰ ਯੂਜ਼ ਕੀਤਾ ਅਤੇ ਫਿਰ ਉਹ ਖਰਾਬ ਹੋ ਜਾਂਦੇ ਨੇ ਅਤੇ ਦੂਜੀ ਗੱਲ ਸਰਦੀਆਂ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ ਸਰਦੀਆਂ ਦੇ ਵਿੱਚ ਤਾਂ ਇਕੱਲਾ ਛਿੜਕਾਓ ਉਹਨਾਂ 'ਚ ਕਰਦੇ ਰਹੋ ਇੱਕ ਦੋ ਮਤਲਬ ਡੇਲੀ ਇੱਕ ਵਾਰੀ ਛਿੜਕਾਵ ਜਿਹਾ ਕਰ ਦਿਓ ਉਹੀ ਪੇੜ ਪੌਦਿਆਂ ਦੇ ਲਈ ਸਫੀਸ਼ੀਐਂਟ ਹੁੰਦਾ ਇਨਫ ਹੁੰਦਾ ਅਤੇ ਸਬਜ਼ੀਆਂ ਵੀ ਛੇਤੀ ਖਰਾਬ ਨਹੀਂ ਹੁੰਦੀਆਂ